ਹੈਲੋ ਫੁਰਸਤ ਰੈਸਟੋਰੈਂਟ ਤੋਂ ਬੋਲ ਰਹੇ ਹੋ ਜੀ ਹਾਂਜੀ ਮੈਂ ਇੱਕ ਨਾ ਔਡਰ ਬੁੱਕ ਕੀਤਾ ਸੀ ਲੰਚ ਦਾ ਸਾਢੇ ਬਾਰ੍ਹਾਂ ਵਜੇ ਐਪ ਤੋਂ ਅਤੇ ਹੁਣ ਡੇਢ ਵੱਜ ਗਿਆ ਹਜੇ ਤੱਕ ਨਹੀਂ ਔਡਰ ਪਹੁੰਚਿਆ ਹੈਗਾ ਅਤੇ ਡਿਲੀਵਰੀ ਟਾਈਮ ਤਾਂ ਅੱਧੇ ਘੰਟੇ ਦਾ ਸੀਗਾ ਜਿਹੜਾ ਡਿਲੀਵਰੀ ਬੋਆਏ ਆ ਸ਼ੋਅ ਹੋ ਰਿਹਾ ਵੀ ਚੱਲ ਪਿਆ ਬਟ ਪਤਾ ਨਹੀਂ ਕਿੱਥੇ ਨਾ ਫੋਨ ਚੱਕ ਰਿਹਾ ਉਹ ਪਤਾ ਨਹੀਂ ਲੱਗ ਰਿਹਾ ਕਿੱਥੇ ਰਹਿ ਗਿਆ ਉਹ ਤੁਸੀਂ ਇਹ ਪਤਾ ਕਰੋ ਵੀ ਕ ਕਿੱਥੇ ਰਹਿ ਗਿਆ ਕੀ ਉਹ ਟਰੈਫਿਕ 'ਚ ਫਸ ਗਿਆ ਕਿ ਕੋਈ ਪੈਂਚਰ ਹੋਇਆ ਕੀ ਚੱਕਰ ਹੈ ਜਿਹੜਾ ਉਹ ਪਹੁੰਚ ਨਹੀਂ ਰਿਹਾ ਹੈ ਅਤੇ ਨਾਲੇ ਅਸੀਂ ਉਰੇ ਲੇਟ ਹੋ ਰਹੇ ਹਾਂ ਡਿਊਟੀ 'ਤੇ ਜਾਣਾ ਅੱਗੇ ਮੇਰੇ ਦੋਸਤਾਂ ਨੇ ਵੀ ਜਾਣਾ ਅੱਗੇ ਹੋਰ ਚੰਡੀਗੜ੍ਹ ਤੱਕ ਜਾਣਾ ਉਹਨਾਂ ਨੇ ਤਿੰਨ ਵਜੇ ਪਹੁੰਚਣਾ ਉੱਥੇ ਅਤੇ ਜਲਦੀ ਪਤਾ ਕਰਕੇ ਦੱਸੋ ਸਾਨੂੰ ਵੀ ਇਹ ਔਡਰ ਲੇਟ ਕਿਉਂ ਹੋ ਰਿਹਾ ਮੋਰਓਵਰ ਜੇ ਓਹ ਤੋਂ ਨਹੀਂ ਤਾਂ ਕੋਈ ਹੋਰ ਬੰਦਾ ਭੇਜੋ ਕਿਵੇਂ ਮਰਜ਼ੀ ਕਰੋ ਕਿ ਔਡਰ ਟਾਈਮ 'ਤੇ ਪਹੁੰਚ ਜਾਵੇ ਦੋ ਵਜੇ ਤੋਂ ਦੋ ਵਜੇ ਤੱਕ ਪਹੁੰਚ ਜਾਵੇ ਸਾਡੇ ਕੋਲ ਜਾਂ ਫਿਰ ਇੱਕ ਮੇਰੇ ਫਰੈਂਡ ਹੈਗੇ ਉਹਦੇ 'ਤੇ ਤੁਹਾਡੇ ਰੈਸਟੋਰੈਂਟ ਦੇ ਕੋਲ ਹੀ ਰਹਿੰਦੇ ਆ ਨਹੀਂ ਫਿਰ ਮੈਂ ਉਹਨਾਂ ਨੂੰ ਕੋਲ ਕਰਦਾ ਵੀ ਤੁਹਾਡੇ ਕੋਲ ਆ ਕੇ ਨਵਾਂ ਜਾਂ ਪ੍ਰਪੇਅਰ ਕਰ ਦਿਓ ਹੈ ਨਾ ਔਡਰ ਅਤੇ ਉਹਨਾਂ ਨੂੰ ਪਕੜਾ ਦਿਓ ਅਤੇ ਉਹ ਸਾਡੇ ਤੱਕ ਪ ਪਹੁੰਚਦਾ ਕਰ ਦੇਣਗੇ ਠੀਕ ਹੈ ਜੀ ਅਤੇ ਜਲਦੀ ਕਾਰਵਾਈ ਕਰੋ ਇਹਦੇ ਉੱਪਰ ਲੇਟ ਹੋ ਰਿਹਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਜੀ ਠੀਕ ਹੈ ਜੀ ਧੰਨਵਾਦ ਜੀ ਓਕੇ